ਸੱਭਿਆਚਾਰਕ ਪ੍ਰੰਪਰਾਵਾਂ ਇਹ ਹਨ ਜਿਵੇਂ ਕਿ ਸਾਉਣ ਮਹੀਲ ਮਹੀਨੇ ਵਿੱਚ ਤੀਆਂ ਆਉਂਦੀਆਂ ਹਨ ਤੀਆਂ ਦਾ ਵੀ ਇੱਕ ਮੇਲਾ ਲੱਗਦਾ ਹੈ ਜਿਸ ਵਿੱਚ ਮੁਟਿਆਰਾਂ ਪੀਂਘਾਂ ਝੂਟਦੀਆਂ ਹਨ ਅਤੇ ਗਿੱਧਾ ਭੰਗੜਾ ਪਾਉਂਦੀਆਂ ਹਨ ਅਤੇ ਖੀਰ ਪੂੜੇ ਬਣਦੇ ਹਨ ਅਤੇ ਮਹਿੰਦੀਆਂ ਮਹਿੰਦੀ ਦੀ ਰਸਮ ਹੁੰਦੀ ਹੈ ਇਸ ਵਿੱਚ ਵਿਆਹ ਦੇ ਵਿੱਚ ਸਾਹੇ ਚਿੱਠੀ ਦਿੰਦੇ ਹਨ ਉਸ ਤੋਂ ਬਾਅਦ ਮਹਿੰਦੀ ਦੀ ਰਸਮ ਹੁੰਦੀ ਹੈ ਜਾਗੋ ਬਟਣਾ ਲੱਗਦਾ ਹੈ ਅਤੇ ਲਾ ਅ ਅਖੀਰ ਵਿੱਚ ਲਾਵਾਂ ਲਾਵਾਂ ਦੀ ਰਸਮ ਹੁੰਦੀ ਹੈ ਉਸ ਤੋਂ ਬਾਅਦ ਮਾਂ ਆਪਣੇ ਪੁੱਤ ਦੇ ਸਿਰ ਤੋਂ ਪਾਣੀ ਵਾਰ ਕੇ ਪੀਂਦੀ ਹੈ